ਹਾਂਜੀ ਮੈਂ ਮਨ ਪਸੰਦ ਭੰਗੜੇ ਦਾ ਆਰੋਬਿਕਸ ਰੂਟੀਨ ਵਰਨਣ ਕਰ ਸਕਦੀ ਹਾਂ ਭੰਗੜਾ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਸ ਨੂੰ ਕਰਨ ਨਾਲ ਮੇਰਾ ਸਰੀਰ ਵੀ ਬਿਲਕੁਲ ਠੀਕ ਹੋ ਗਿਆ ਹੈ ਭੰਗੜੇ ਨੂੰ ਆਪਣੇ ਰੂਟੀਨ 'ਚ ਸ਼ਾਮਲ ਕਰਨ ਨਾਲ ਮੈਨੂੰ ਬਹੁਤ ਚੰਗਾ ਲੱਗਿਆ ਹੈ ਅੱਜ ਕੱਲ੍ਹ ਦੇ ਲੋਕ ਬੁੱਢੇ ਬੱਚੇ ਸਾਰੇ ਭੰਗੜਾ ਕਰਕੇ ਖੁਸ਼ ਹੁੰਦੇ ਹਨ ਸਾਡੇ ਘਰ ਦੇ ਸਾਹਮਣੇ ਇੱਕ ਪਾਰਕ ਵਿੱਚ ਰੋਜ਼ ਭੰਗੜਾ ਕਰਵਾਇਆ ਜਾਂਦਾ ਹੈ ਜਿਸ ਨੂੰ ਕਰਨ ਨਾਲ ਸਭ ਬਹੁਤ ਖੁਸ਼ ਹੁੰਦੇ ਹਨ ਭੰਗੜਾ ਇੱਕ ਬਹੁਤ ਵਧੀਆ ਚੀਜ਼ ਹੈ ਜਿਸ ਵਿੱਚ ਭਾਗ ਲੈਣ ਨਾਲ ਸਰੀਰ ਵੀ ਤੇਜ਼ ਹੋ ਜਾਂਦਾ ਹੈ ਅਤੇ ਆਪਣਾ ਸਰੀਰ ਹਲਕਾ ਵੀ ਹੋ ਜਾਂਦਾ ਹੈ ਇਸ ਨੂੰ ਕਰਨ ਨਾਲ ਤੁਹਾਡੇ ਸਰੀਰ ਵਿੱਚ ਹਰ ਤਰ੍ਹਾਂ ਦੀ ਲਚਕ ਵੀ ਆ ਜਾਂਦੀ ਹੈ ਭੰਗੜਾ ਇੱਕ ਬਹੁਤ ਵਧੀਆ ਬਹੁਤ ਹੀ ਵਧੀਆ ਇੱਕ ਐਕਸਰਸਾਈਜ਼ ਦਾ ਕੰਮ ਵੀ ਕਰਦੀ ਹੈ ਜਿਹਨੂੰ ਕਰਨ ਦੇ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਂਗੇ ਭੰਗੜਾ ਅਰੋਬਿਕਸ ਅੱਜ ਕੱਲ੍ਹ ਦੇ ਜਵਾਨਾਂ ਦਾ ਇੱਕ ਸ਼ੌਂਕ ਵੀ ਬਣ ਗਿਆ ਹੈ ਜਿਹਨੂੰ ਸਾਰੇ ਬਹੁਤ ਖੁਸ਼ੀ ਖੁਸ਼ੀ ਨਾਲ ਕਰਦੇ ਹਨ ਇਸ ਕਰਕੇ ਸਾਨੂੰ ਭੰਗੜਾ ਆਪਣੇ ਰੂਟੀਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਭੰਗੜਾ ਇੱਕ ਅਰੋਬਿਕਸ ਦਾ ਰੂਪ ਵੀ ਲੈ ਰਿਹਾ ਹੈ ਜਿਸ ਨਾਲ ਸਾਡਾ ਸਰੀਰ ਵੀ ਬਿਲਕੁਲ ਤੰਦਰੁਸਤ ਹੋ ਰਿਹਾ ਹੈ ਭੰਗੜਾ ਕਰਨਾ ਸਾਡੇ ਸਰੀਰ ਲਈ ਸਭ ਤੋਂ ਵਧੀਆ ਹੈ ਜਿਸ ਨਾਲ ਹਰ ਤਰ੍ਹਾਂ ਸਰੀਰ ਬਿਲਕੁਲ ਠੀਕ ਅਤੇ ਤੰਦਰੁਸਤ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਭੰਗੜਾ ਆਪਣੇ ਰੂਟੀਨ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਬਿਲਕੁਲ ਤੰਦਰੁਸਤ ਹੋ ਜਾਵਾਂਗੇ